ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਗੁਰਪ੍ਰੀਤ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਜੀ ਇਸ ਕਾਲ ਰਾਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਕੱਲ੍ਹ ਤੁਹਾਡੀ ਇੱਕ ਕੈਬ ਬੁੱਕ ਕੀਤੀ ਸੀ ਜਿਸ ਦਾ ਤੁਸੀਂ ਮੈਨੂੰ ਸੱਤ ਸੌ ਰੁਪਇਆ ਕਿਰਾਇਆ ਕਿਹਾ ਸੀ ਪਰ ਜਦੋਂ ਮੈਂ ਕੈਬ 'ਚ ਸਫ਼ਰ ਕੀਤਾ ਤਾਂ ਤੁਹਾਡੇ ਡਰਾਈਵਰ ਨੇ ਮੇਰੇ ਤੋਂ ਸੱਤ ਸੌ ਦੀ ਬਜਾਏ ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਜਦੋਂ ਮੈਂ ਉਹਨੂੰ ਦੱਸਿਆ ਕਿ ਕਿਰਾਇਆ ਸੱਤ ਸੌ ਦੀ ਗੱਲ ਹੋਈ ਸੀ ਤਾਂ ਉਸ ਇਨਸਾਨ ਨੇ ਮੈਨੂੰ ਉੱਥੇ ਲੋਕਾਂ ਸਾਹਮਣੇ ਉਹ ਜ਼ਲੀਲ ਕੀਤਾ ਫਿਰ ਮੈਨੂੰ ਉਸ ਨੂੰ ਇੱਕ ਹਜ਼ਾਰ ਰੁਪਇਆ ਦੇਣਾ ਪਿਆ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਿਰਪਾ ਕਰਕੇ ਮੈਨੂੰ ਮੇਰਾ ਤਿੰਨ ਸੌ ਰੁਪਇਆ ਵਾਪਿਸ ਮੋੜਿਆ ਜਾਵੇ ਅਤੇ ਉਸ ਇਨਸਾਨ ਨੂੰ ਸਮਝਾਇਆ ਜਾਵੇ ਕਿ ਗਲਤੀ ਮੰਨੇ ਉਸਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ ਅਤੇ ਅੱਗੇ ਤੋਂ ਇਹ ਧਿਆਨ ਰੱਖਿਆ ਜਾਵੇ ਕਿ ਜਿੰਨੇ ਜਿਸ ਜਿੰਨੇ ਪੈਸੇ ਦੀ ਗੱਲ ਹੋ ਕੀਤੀ ਹੋਵੇ ਉੰਨੇ 'ਚ ਸਹਿਮਤ ਹੋਣਾ ਚਾਹੀਦਾ